ਹਾਂ ਮੈਂ ਨਾਪਤੋਲ ਤੋਂ ਇੱਕ ਬੈੱਡ ਮੰਗਵਾਇਆ ਸੀ ਜੋ ਕਿ ਮੈਨੂੰ ਬਾਅਦ ਵਿੱਚ ਦੱਬਣ ਲੱਗ ਗਿਆ ਉਹਦੀ ਲੱਕੜੀ ਖ਼ਰਾਬ ਹੋ ਗਈ ਰੰਗ ਵੀ ਉਹਦਾ ਉਤਰ ਗਿਆ ਔਰ ਮੈਨੂੰ ਇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਮੈਂ ਨਾਪਤੋਲ ਤੋਂ ਸਾਮਾਨ ਮੰਗਵਾ ਕੇ ਬੈੱਡ ਮੰਗਵਾ ਕੇ ਪੈਸੇ ਬਰਬਾਦ ਕਰ ਲਏ ਨੇ